ਸਾਡੇ ਪਿੰਡ ਵਿੱਚ ਬਹੁਤ ਸਾਰੇ ਇਹੋ ਜਿਹੇ ਕਾਰਣ ਹਨ ਜਿੰਦੇ ਵਜਾਹ ਨਾਲ ਜਿਸ ਵਜਾਹ ਨਾਲ ਪਿੰਨ ਨੂੰ ਪਿੰਡ ਵਾਲਿਆਂ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਵੱਡਾ ਕਾਰਨ ਹੈ ਗੰਦਗੀ ਪਿੰਡ ਦੇ ਵਿੱਚ ਸਰਪੰਚ ਨੂੰ ਬਹੁਤ ਵਾਰ ਇਹ ਦੱਸਿਆ ਗਿਆ ਹੈ ਕਿ ਪਿੰਡ ਦੀ ਸਾਫ਼ ਸਫ਼ਾਈ ਅਤੇ ਨਾਲੀਆਂ ਨੂੰ ਬੰਦ ਕਰਵਾਇਆ ਜਾਵੇ ਪਰ ਕੋਈ ਵੀ ਐਕਸ਼ਨ ਨਹੀਂ ਹੋ ਪਾ ਰਿਹਾ ਸਾਡੇ ਪਿੰਡ ਵਿੱਚ ਬਹੁਤ ਗੰਦਾ ਕੰਮ ਹੋ ਰਿਹਾ ਹੈ ਜੋ ਕਿ ਹੈ ਨਸ਼ੇ ਵੇਚਣਾ ਜੋ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਭੜਕਾ ਰਿਹਾ ਹੈ ਅਤੇ ਨਸ਼ਿਆਂ ਵੱਲ ਆਕਰਸ਼ਿਤ ਕਰ ਰਿਹਾ ਹੈ ਅਨਪੜ੍ਹਤਾ ਵੀ ਇੱਕ ਐਸੀ ਚੀਜ਼ ਹੈ ਜੋ ਕਿ ਸਾਡੇ ਪਿੰਡ ਵਿੱਚ ਬਹੁਤ ਵੱਧ ਰਹੀ ਹੈ ਲੋਕ ਆਪਣੇ ਬੱਚਿਆਂ ਨੂੰ ਕੰਮਾਂ 'ਤੇ ਭੇਜ ਰਹੇ ਹਨ ਲੇਕਿਨ ਸਕੂਲ ਨਹੀਂ ਭੇਜ ਰਹੇ ਜੋ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਤੇ ਚੋਰੀ ਚੋਰ ਬਜ਼ਾਰੀ ਵੀ ਇੱਕ ਐਸੀ ਚੀਜ਼ ਹੈ ਜਿਸ ਨੇ ਸਾਡੇ ਪਿੰਡਾਂ ਵਾਲਿਆਂ ਨੂੰ ਬਹੁਤ ਦੁਖੀ ਕੀਤਾ ਹੈ ਰੋਜ਼ਾਨਾ ਚੋਰ ਆਉਂਦੇ ਹਨ ਅਤੇ ਕੋਈ ਵੀ ਚੋਰੀ ਕਰਕੇ ਚਲੇ ਜਾਂਦੇ ਹਨ ਇਹ ਗੱਲ ਅਸੀਂ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਪੰਚ ਅਤੇ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਲੇਕਿਨ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਹੁੰਦਾ ਉਹ ਇੱਕ ਦਿਨ ਚੋਰ ਫੜ ਲੈਂਦੇ ਹਨ ਅਤੇ ਦੋ ਦਿਨ ਬਾਅਦ ਉਹ ਛੱਡਦੇ ਹਨ ਜੋ ਕਿ ਬਹੁਤ ਮਾੜੀ ਗੱਲ ਹੈ ਧੰਨਵਾਦ